ਭੰਗੜਾ ਐਰੋਬਿਕਸ ਇੱਕ ਯੂਨੀਕ 'ਤੇ ਇੱਕ ਡਾਇਨਾਮਿਕ ਡਿਫਰੈਂਟ ਐਕਸਰਸਾਈਜ਼ ਦਾ ਟਾਈਪ ਆ ਫੋਰਮ ਕਹਿ ਲਓ ਜਿਹੜਾ ਕੀ ਕੰਬਾਈਨ ਕਰਦਾਇਆ ਟਰਡੀਸ਼ਨਲ ਪੰਜਾਬੀ ਡਾਂਸ ਮੂਵਸ ਨਾਲ ਹੀ ਉਹਨੂੰ ਐਰੋਬਿਕ ਫਿਟਨੈਸ ਨਾਲ ਜੋੜਦਾ ਹੈ ਜਿਹਦੇ ਕਰਕੇ ਹੈਲਥ ਬਹੁਤ ਵਧੀਆ ਰਹਿੰਦੀ ਐ ਨਾਲੇ ਪਰਸਨ ਆਪਣੀ ਬੋਡੀ ਨੂੰ ਲੈ ਕੇ ਬਹੁਤ ਵਧੀਆ ਫੀਲ ਕਰਦੇ ਹਨ ਇਹਦੇ ਵਿੱਚ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਵੇਅ ਆ ਜਾਂ ਫਿਰ ਕਹਿ ਲਓ ਵੀ ਅੱਡ ਅੱਡ ਤਰੀਕੇ ਹਨ ਵੀ ਪਾਰਟੀਸੀਪੈਂਟ ਕਿਵੇਂ ਇੰਸਪਾਇਰ ਹੁੰਦੇ ਇਹ ਚੀਜ਼ਾਂ ਤੋਂ ਕਿਉਂ ਹੁੰਦੇ ਇੰਸਪਾਇਰ ਪਹਿਲਾਂ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਐਕਸਪ੍ਰੈਸਿਵ ਮੂਵਮੈਂਟਸ ਹੁੰਦੇ ਆ ਜਿਹਦੇ ਵਿੱਚ ਵੀ ਪਾਰਟੀਸੀਪੈਂਟ ਇਕਦਮ ਆਪਦੇ ਅੰਦਰੋਂ ਰੂਹ ਵਿੱਚੋਂ ਐਕਸਪ੍ਰੈਸਿਵ ਹੁੰਦਾ ਖੁੱਲ ਕੇ ਨੱਚਦਾ ਐ ਭੰਗੜਾ ਕਰਦਾ ਐਕਸਰਸਾਈਜ਼ ਕਰਦਾ ਹੈ ਜਿਹਦੇ ਉਹ ਵੀ ਬਹੁਤ ਅਲੱਗ ਅਲੱਗ ਪ੍ਰਕਾਰ ਦੇ ਹੁੰਦੇ ਹੈ ਜਿਵੇਂ ਕੀ ਬੋਲਡ ਹੁੰਦੇ ਆ ਐਨਰਜੈਟਿਕ ਹੁੰਦੇ ਆ ਹੋਰ ਵੀ ਕਾਫੀ ਟਾਈਪਸ ਹੁੰਦੇ ਆ ਜਿਹਦੇ ਕਰਕੇ ਪਾਰਟੀਸੀਪੈਂਟ ਬਹੁਤ ਹੀ ਫਰੀਲੀ ਮੂਵ ਕਰਦਾਇਆ ਆਪਦੇ ਨਾਲ ਉਹਨੂੰ ਆਪਦੇ ਮੈਂਟਲ ਹੈਲਥ ਵੀ ਉਹਦਾ ਬਹੁਤ ਜ਼ਿਆਦਾ ਫ੍ਰੀ ਹੋ ਜਾਂਦਾ ਜਿਹਦੇ ਕਰਕੇ ਉਹਦੇ ਫਿਜ਼ੀਕਲ ਫਿਟਨੈਸ ਉਹਦੀ ਰੂਟੀਨ ਡੇਲੀ ਰੂਟੀਨ ਬਹੁਤ ਸੁਧਰ ਜਾਂਦੀ ਹੈ ਤੇ ਉਹ ਆਪਦੇ ਮਾਇੰਡ ਦੇ ਵਿੱਚ ਨਿਊ ਆਈਡੀਆਜ਼ ਕ੍ਰੀਏਟ ਕਰਦਾ ਹਾ ਤੇ ਆਪਦੇ ਆਪ ਨੂੰ ਬਹੁਤ ਚੰਗੇ ਤਰ੍ਹਾਂ ਨਾਲ ਐਕਸਪ੍ਰੈਸ ਕਰਦਾ ਹੋਰ ਦੂਜਾ ਕਹਿ ਸਕਦੇ ਆਂ ਵੀ ਉਹਨੂੰ ਭੰਗੜਾ ਐਰੋਬਿਕਸ ਨਾਲ ਉਹ ਬਹੁਤ ਫਾਸਟ ਪੀਸ ਮਿਊਜ਼ਿਕ ਹੁੰਦਾ ਜਿਹਦੇ ਕਰਕੇ ਪਾਰਟੀਸੀਪੈਂਟ ਦੇ ਮਾਇੰਡਸ ਬਹੁਤ ਐਨਕ੍ਰੇਜ਼ ਹੁੰਦੇ ਆ ਉਹਨਾਂ ਦੇ ਮੂਵਮੈਂਟਸ ਜਿਹੜੀਆਂ ਮਿਊਜ਼ੀਕ ਦੀਆਂ ਜਿਹੜੀਆਂ ਰੀਦਮਸ ਹੁੰਦੀਆਂ ਉਹ ਬਹੁਤ ਜ਼ਿਆਦਾ ਅਫੈਕਟ ਕਰਦੀਆਂ ਮਾਇੰਡਸ ਮੈਂਟਲ ਹੈਲਥ ਨੂੰ ਜਿਹਦੇ ਕਰਕੇ ਬੰਦਾ ਬਹੁਤ ਜ਼ਿਆਦੇ ਐਨਰਜੈਟਿਕ ਬਹੁਤ ਵਧੀਆ ਫੀਲ ਕਰਦਾ ਹੈ ਤੇ ਉਹਦਾ ਦਿਨ ਉਹਦੇ ਕਰਕੇ ਪੂਰਾ ਬਹੁਤ ਵਧੀਆ ਜਾਂਦਾ ਤੇ ਉਹਦਾ ਕੰਮ ਵਿੱਚ ਧਿਆਨ ਲੱਗਿਆ ਰਹਿੰਦਾ ਹੈ ਤਾਂ ਕਰਕੇ ਬਹੁਤ ਜ਼ਿਆਦਾ ਪਾਰਟੀਸੀਪੈਂਟਸ ਐਰੋਬਿਕਸ ਕਹਿ ਲਓ ਭੰਗੜਾ ਕਹਿ ਲਓ ਆਹ ਇਹੋ ਜਿਹੀਆਂ ਐਕਸਰਸਾਈਜ਼ਾਂ ਵਿੱਚ ਜ਼ਿਆਦਾ ਇਨਵੋਲਵ ਹੁੰਦੇ ਆ ਕ੍ਰੀਏਟੀਵਿਟੀ ਦਿਖਾਉਂਦੇ ਆ ਜਿਹਦੇ ਕਰਕੇ ਉਹਨਾਂ ਨੂੰ ਨਾਲੇ ਆਪਦਾ ਇੱਕ ਟਰਡੀਸ਼ਨਲ ਡਾਂਸ ਵੀ ਸਿੱਖ ਸਕਦੇ ਆਂ ਉਹਦੇ ਵਿੱਚ ਕਾਫੀ ਡਿਫਰੈਂਟ ਐਲੀਮੈਂਟ ਸਿੱਖ ਸਕਦੇ ਆਂ ਉਹ ਪਰਫੋਰਮ ਕਰ ਸਕਦੇ ਆਂ ਕਾਫੀ ਜਗ੍ਹਾ ਦੇ ਵਿੱਚ ਇਹਦੇ ਕਰਕੇ ਪਾਰਟੀਸੀਪੈਂਟ ਬਹੁਤ ਜ਼ਿਆਦਾ ਪਾਰਟੀਸੀਪੇਟ ਕਰਦੇ ਨੇ